ਮੈਨੂੰ ਚਿੱਤਰਕਾਰੀ ਦੇ ਸਮੇਂ ਦੌਰਾਨ ਬਹੁਤ ਜ਼ਿਆਦਾ ਮੁਸ਼ਕਲਾਂ ਤਾਂ ਨਹੀਂ ਆਉਂਦੀਆਂ ਪਰ ਅਕਸਰ ਦੋ ਜਾਂ ਤਿੰਨ ਚੀਜ਼ਾਂ ਜੋ ਮੈਨੂੰ ਬਹੁਤ ਜ਼ਿਆਦਾ ਤੰਗ ਜਾਂ ਪਰੇਸ਼ਾਨ ਕਰਦੀਆਂ ਹਨ ਵਿੱਚੋਂ ਇੱਕ ਤਾਂ ਸਮੇਂ ਦੀ ਘਾਟ ਸਮੇਂ ਦੀ ਘਾਟ ਹੋਣ ਕਾਰਨ ਮੈਂ ਅਕਸਰ ਆਪਣੀ ਇਸ ਰੁਚੀ ਨੂੰ ਟਾਈਮ ਨਹੀਂ ਦੇ ਪਾਉਂਦੀ ਪਰ ਜਦੋਂ ਵੀ ਮੇਰੇ ਕੋਲ ਫਰੀ ਟਾਈਮ ਹੁੰਦਾ ਹੈ ਤਾਂ ਮੈਂ ਇਸ ਨੂੰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੀ ਹਾਂ ਅਤੇ ਦੂਜਾ ਮੇਰੇ ਕੰਮ ਦੇ ਵਿੱਚ ਮੈਨੂੰ ਸ਼ਾਂਤੀ ਪਸੰਦ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਰੌਲੇ ਰੱਪੇ ਦੀ ਆਦਤ ਨਹੀਂ ਹੈ ਪਰ ਜਦੋਂ ਵੀ ਮੈਂ ਇਸਨੂੰ ਘਰੇ ਕਰਦੀ ਹਾਂ ਤਾਂ ਬੱਚੇ ਅਕਸਰ ਸ਼ੋਰ ਕਰਦੇ ਹਨ ਅਤੇ ਪਿਛਲੇ ਇਹ ਦਿਨ ਵੀ ਇੱਕ ਸਾਡੇ ਰਿਸ਼ਤੇਦਾਰਾਂ ਦੇ ਬੱਚੇ ਨੇ ਮੇਰੇ ਚਿੱਤਰਕਾਰੀ ਦਾ ਕੈਨਵਸ ਬਿਲਕੁਲ ਖਰਾਬ ਕਰ ਦਿੱਤਾ ਜਿਸ ਨੇ ਕਿ ਮੈਨੂੰ ਬਹੁਤ ਜ਼ਿਆਦਾ ਉਦਾਸ ਕੀਤਾ ਅਤੇ ਮੈਂ ਬਹੁਤ ਜ਼ਿਆਦਾ ਗਲਤੀਆਂ ਵੀ ਕਰਦੀ ਹਾਂ ਅਤੇ ਇਹਨਾਂ ਨੂੰ ਸੁਧਾਰਨ ਦਿਉ ਸੁਧਾਰਨ ਲਈ ਅਕਸਰ ਇੰਟਰਨੈੱਟ ਤੋਂ ਸੁਵਿਧਾ ਲੈਂਦੀ ਹਾਂ ਜਿਵੇਂ ਕਿ ਅਲੱਗ ਅਲੱਗ ਤਰ੍ਹਾਂ ਦੇ ਕਲਰ ਅਤੇ ਮਿਕਸਚਰ ਬਣਾਉਣੇ ਹੋਣ